ਦਸ ਅਕਤੂਬਰ ਉੱਨੀ ਸੌ ਛਪੰਜਾ ਤੀਹ ਅਪ੍ਰੈਲ ਉੱਨੀ ਸੌ ਉਣਾਸੀ ਵੀਹ ਅਪ੍ਰੈਲ ਉੱਨੀ ਸੌ ਉਣਾਸੀ ਪੰਦਰ੍ਹਾਂ ਜੂਨ ਦੋ ਹਜ਼ਾਰ ਤਿੰਨ ਬਾਈ ਜੂਨ ਦੋ ਹਜ਼ਾਰ ਛੇ